ਸਾਡੇ ਇਲਾਕੇ ਵਿੱਚ ਬਹੁਤ ਲੋਕ ਵਹਿਮਾਂ ਭਰਮਾਂ 'ਤੇ ਵਿਸ਼ਵਾਸ ਕਰਦੇ ਆ ਬਹੁਤ ਸਾਰੇ ਲੋਕ ਵਹਿਮਾਂ ਭਰਮਾਂ ਵਿੱਚ ਆ ਕੇ ਬਹੁਤ ਹੀ ਟੂਣੇ ਕਰਦੇ ਹਨ ਉਹਨਾਂ ਵਹਿਮਾਂ ਭਰਮਾਂ ਵਿੱਚੋਂ ਕੁਛ ਵਹਿਮ ਇਹ ਨੇ ਕਿ ਲੋਕ ਆਪਣੇ ਘਰ ਦੇ ਮੂਹਰੇ ਟੁੱਟੀ ਹੋਈ ਜੁੱਤੀ ਟੰਗਦੇ ਨੇ ਨਿੰਬੂ ਮਿਰਚੀ ਆਪਣੀ ਦੁਕਾਨ 'ਤੇ ਟੰਗ ਕੇ ਰੱਖਦੇ ਨੇ ਤਾਂ ਕਿ ਉਹ ਆਪਣੇ ਘਰ ਨੂੰ ਅਤੇ ਆਪਣੀ ਦੁਕਾਨ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖ ਲੈਣ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਵਹਿਮ ਭਰਮ ਨੇ ਜਿਹੜੇ ਲੋਕ ਉਹਨਾਂ 'ਤੇ ਵਿਸ਼ਵਾਸ ਕਰਦੇ ਨੇ ਅਤੇ ਬਹੁਤ ਸਾਰੇ ਟੂਣੇ ਟੱਪੇ ਵੀ ਕਰਦੇ ਨੇ